ਸਤਿ ਸ਼੍ਰੀ ਅਕਾਲ ਜੀ ਮੈਂ ਕਾਰਤਿਕ ਬੋਲ ਰਿਹਾ ਪਠਾਨਕੋਟ ਤੋਂ ਮੈਂ ਤੁਹਾਨੂੰ ਬੱਸ ਬਾਰੇ ਦੱਸਣਾ ਸੀ ਬੱਸ ਦੇ ਵਿੱਚ ਸਫ਼ਰ ਕਰਨ ਦਾ ਆਨੰਦ ਕਾਫ਼ੀ ਆਉਂਦਾ ਮੈਂ ਵੀ ਇੱਕ ਵਾਰ ਗਿਆ ਸੀ ਆਪਣੇ ਫਰੈਂਡਸ ਨਾਲ ਗਿਆ ਸੀ ਬੱਸ ਵਿੱਚ ਪਠਾਨਕੋਟ ਤੋਂ ਕਟਰਾ ਵੈਸ਼ਨੋ ਦੇਵੀ ਅਤੇ ਸਾਨੂੰ ਬੱਸ ਵਿੱਚ ਕਾਫ਼ੀ ਜ਼ਿਆਦਾ ਸਹੂਲਤਾਂ ਸੀ ਅਤੇ ਬੱਸ ਵਿੱਚ ਏ ਸੀ ਵੀ ਲੱਗਿਆ ਹੋਇਆ ਸੀ ਜਿਸ ਨਾਲ ਸਾਨੂੰ ਗਰਮੀਆਂ ਦਾ ਮੌਸਮ ਸੀ ਸਾਨੂੰ ਗਰਮੀਆਂ ਦੀ ਬਿਲਕੁਲ ਵੀ ਇੰਨੀ ਗਰਮੀ ਮਹਿਸੂਸ ਨਹੀਂ ਹੋਈ ਕਿਉਂਕਿ ਬੱਸ ਵਿੱਚ ਏ ਸੀ ਲੱਗਿਆ ਹੋਇਆ ਸੀ ਔਰ ਬੱਸ ਡੀਜ਼ਲ ਨਾਲ ਚੱਲਣ ਵਾਲੀ ਸੀ ਔਰ ਉਸਦੀ ਸੀਟਾਂ ਵੀ ਕਾਫ਼ੀ ਵਧੀਆ ਸੀ ਉਹਦੇ ਵਿੱਚ ਸਾਨੂੰ ਸਫ਼ਰ ਯਾਤਰਾ ਕਰਨ ਦਾ ਕਾਫ਼ੀ ਆਨੰਦ ਆਇਆ ਅਤੇ ਅ ਅਸੀਂ ਬੱਸ ਵਿੱਚ ਹੀ ਅੱਗੇ ਤੋਂ ਜਾਣਾ ਚਾਹਵਾਂਗੇ ਕਿਉਂਕਿ ਬ ਬੱਸ ਬੱਸ ਕਾਫ਼ੀ ਕਾਫ਼ੀ ਆਨੰਦ ਅਨੰਦਪੂਰਵਕ ਹੈਗੀ ਆ ਬੱਸ ਸਾਨੂੰ ਦੂਰ ਦੂਰ ਲੈ ਜਾ ਸਕਦੀ ਆ ਬੱਸ ਉਸ ਵਿੱਚ ਏ ਸੀ ਵੀ ਲੱਗਿਆ ਸੀ ਔਰ ਟਾਈਮ ਪਾਸ ਕਰਨ ਵਾਲੇ ਟੀ ਵੀ ਵੀ ਲੱਗਿਆ ਹੋਇਆ ਸੀ ਕਿਉਂਕਿ ਬੱਸ ਵਿੱਚ ਦੂਰ ਦੂਰ ਦਾ ਸਫ਼ਰ ਹੁੰਦਾ ਇਸ ਲਈ ਕਈ ਬੋਰ ਵੀ ਹੋ ਜਾਂਦੇ ਆ ਅਤੇ ਬੱਸ ਵਿੱਚ ਟੀ ਵੀ ਗਾਣੇ ਸੁਣਨ ਲਈ ਅਤੇ ਗਾਣੇ ਸੁਣਨ ਲਈ ਬੂਫਰ ਵੀ ਲੱਗੇ ਹੋਏ ਸਨ ਜੋ ਦਿਲ ਕੀਤਾ ਸੋ ਕਰ ਲਿਆ ਅਤੇ ਟਾਈਮ ਵੀ ਪਾਸ ਹੋ ਜਾਂਦਾ ਸੀ ਅਤੇ ਸਾਡੀ ਯਾਤਰਾ ਵੀ ਬਹੁਤ ਅੱਛੀ ਗਈ ਔਰ ਬੱਸ ਵਿੱਚ ਸਫ਼ਰ ਕਰਨ ਦਾ ਆਨੰਦ ਵੀ ਕਾਫ਼ੀ ਆਇਆ ਬੱਸ ਬਹੁਤ ਵਧੀਆ ਵਧੀਆ ਗੱਡੀ ਹੈਗੀ ਆ ਇਹ ਡ ਡੀਜ਼ਲ 'ਤੇ ਚਲਦੀ ਹੈਗੀ ਹੈ ਔਰ ਡੀਜ਼ਲ ਵੀ ਕਾਫ਼ੀ ਸਸਤਾ ਹੈਗਾ ਜਿਸ ਨਾਲ ਬੱਸ ਵਾਲਿਆਂ ਨੂੰ ਵੀ ਕਾਫ਼ੀ ਫ਼ਾਇਦਾ ਹੋ ਜਾਂਦਾ ਧੰਨਵਾਦ